ਹੈਲੋ ਗੁਡ ਮੋਰਨਿੰਗ ਸਰ ਸਰ ਮੈਂ ਅੱਗੇ ਵੀ ਤੁਹਾਡੀ ਬੇਕਰੀ ਤੋਂ ਬਹੁਤ ਵਾਰ ਮਤਲਬ ਆਈਟਮ ਮੰਗਵਾ ਚੁੱਕਿਆਂ ਬਹੁਤ ਵਧੀਆ ਲੱਗੀ ਮੈਨੂੰ ਆਪ ਜੀ ਬੇਕ ਤੁਹਾਡੀ ਬੇਕਰੀ ਦਾ ਨਾਮ ਆਪਣੇ ਹਿਮਾਲਿਆ ਬੇਕਰੀ ਹੈ ਬਹੁਤ ਵਧੀਆ ਲੱਗਦਾ ਮਤਲਬ ਜਦੋਂ ਮੈਂ ਆਰਡਰ ਕਰਨਾ ਉਤੋਂ ਅੱਗੋਂ ਮੈਨੂੰ ਮਤਲਬ ਬੈਸਟ ਬੈਸਟ ਤਰ੍ਹਾ ਨਾਲ ਮਤਲਬ ਡੀਲ ਕੀਤਾ ਜਾਂਦਾ ਮੈਨੂੰ ਅਤੇ ਇਸ ਕਰਕੇ ਮੈਂ ਆਰਡਰ ਕਰਨਾ ਚਾਹੁੰਦਾ ਸੀ ਇੱਕ ਮਸਾਲਾ ਡੋਸਾ ਇੱਕ ਪੀਜ਼ਾ ਅਤੇ ਇੱਕ ਹੋਰ ਕਰ ਲਓ ਫਰਾਈ ਫਰਾਈਡ ਰਾਈਜ ਅਤੇ ਮਨਚੂਰੀਅਨ ਤੇ ਲਾਸਟ ਇੱਕ ਮਸਾਲਾ ਟਾਈਮ ਟਾਈਮ ਕਿਦ ਟਾਈਮ ਕਿੰਨਾ ਲੱਗੂਗਾ ਅਤੇ ਅਸੀਂ ਮੇਰਾ ਐਡਰੈਸ ਵੈਸੇ ਹੈ ਇੰਦਰਾ ਕਲੋਨੀ ਮੈਂ ਇੰਦਰਾ ਕਲੋਨੀ ਡਿਲੀਵਰੀ ਚਾਹੁੰਦਾ ਕਿੰਨਾ ਟਾਈਮ ਲੱਗੂਗਾ ਅਤੇ ਪੇਮੈਂਟ ਕਿੰਨੀ ਬਣੀ ਬਣੂਗੀ ਪੇਮੈਂਟ ਔਨਲਾਈਨ ਕਰਦਾ ਜਾਂ ਕੈਸ਼ ਆਨ ਡਿਲੀਵਰੀ ਹੋਵੇਗੀ ਬਟ ਮੈਨੂੰ ਇਹ ਕਿ ਕਿੰਨਾ ਟਾਈਮ ਵੀ ਕਿੰਨਾ ਲੱਗੂਗਾ ਮੈਨੂੰ ਇਹ ਵੀ ਦੱਸ ਦਿਓ ਅਤੇ ਜਲਦੀ ਤੋਂ ਜਲਦੀ ਚਾਹੀਦੀ ਹੈ ਵੈਸੇ ਕਿਉਂਕਿ ਘਰ ਗੈਸਟ ਆਏ ਹੋਏ ਨੇ ਅਤੇ ਇਸ ਕਰਕੇ ਉਹਨਾਂ ਨੇ ਅੱਗੇ ਵੀ ਤੁਹਾਡਾ ਮਤਲਬ ਟਰਾਈ ਕੀਤਾ ਹੋਇਆ ਫੂਡ ਵਗੈਰਾ ਨਾ ਤਾਂ ਵਧੀਆ ਲੱਗਿਆ ਸੀ ਉਹਨਾਂ ਨੂੰ ਇਸ ਕਰਕੇ ਮੈਂ ਫਿਰ ਉਹਨਾਂ ਨੂੰ ਤੁਹਾਡੀ ਬੇਕਰੀ ਦਾ ਹੀ ਕੁਛ ਵਧੀਆ ਖਵਾਉਣਾ ਚਾਹੁੰਦਾ ਅਤੇ ਤੁਹਾਡੀ ਸਰਵਿਸ ਬੜੀ ਚੰਗੀ ਹੈ ਇਸ ਕਰਕੇ ਮੈਂ ਚਾਹੁੰਦਾ ਕਿ ਛੇਤੀ ਤੋਂ ਛੇਤੀ ਹੋ ਜਾਵੇ ਤਾਂ ਕਿ ਉਹ ਗੈਸਟ ਮੇਰੇ ਨਾਰਾਜ਼ ਨਾ ਹੋ ਕੇ ਜਾਣ ਤੁਹਾਡਾ ਬੈਸਟ ਖਾਣਾ ਖਾ ਕੇ ਜਾਣ